ਯੂ ਪੀ ਐੱਸ ਸੀ ਬਾਏ ਖਾਨ ਸਰ ਸੋ ਉਥੇ ਕੀ ਹੈ ਕਿ ਜਿਹੜੇ ਪਿੰਡਾਂ ਵਾਲੇ ਬੱਚੇ ਵੀ ਨੇ ਉਹ ਵੀ ਇੱਕ ਆਈ ਏ ਐੱਸ ਲੈਵਲ ਦੀ ਸਟੱਡੀ ਨੂੰ ਪੜ੍ਹ ਰਹੇ ਆ ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸੋ ਇਹ ਚੀਜ਼ਾਂ ਜਿਹੜੀ ਔਨਲਾਈਨ ਬੱਚਿਆਂ ਨੂੰ ਜਿਹੜੀ ਹੈ ਉਹ ਮੁਫਤ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ ਅਤੇ ਮੈਂ ਵੀ ਕਾਫੀ ਸਾਰੇ ਯੂਟਿਊਬ ਜਿਹੜੇ ਚੈਨਲ ਫੋਲੋ ਕਰ ਰਹੀ ਹਾਂ ਉਹ 'ਚ ਜਿਸ 'ਚ ਮੈਂ ਜਿੱਦਾਂ ਕਿ ਮੈਂ ਪਹਿਲਾਂ ਕਹਿ ਕੇ ਹਟੀ ਹਾਂ ਕਿ ਆਈ ਏ ਐੱਸ ਬਾਏ ਖਾਨ ਸਰ ਸੋ ਬੇਸਿਕਲੀ ਜਿਹੜੇ ਇਵੇਂ ਦੇ ਚੈਨਲ ਨੇ ਉਹ ਬੱਚਿਆਂ ਦੇ ਲਈ ਕਾਫੀ ਸਾਰੇ ਹੈਲਪਫੁਲ ਚੈਨਲ ਰਹਿ ਰਹੇ ਨੇ